ਸਾਡੇ ਇਲਾਕੇ ਵਿੱਚ ਜ਼ਿਆਦਾਤਰ ਲੋਕੀਂ ਠੰਡੀਆਂ ਅਤੇ ਖੁੱਲ੍ਹੀਆਂ ਇਲਾਕੇ ਵਿੱਚ ਜਾਣਾ ਪਸੰਦ ਕਰਦੇ ਹਨ ਕਿਉਂਕਿ ਸਾਡਾ ਇਲਾਕਾ ਇੱਕ ਗਰਮ ਇਲਾਕਾ ਹੈ ਅਤੇ ਇੱਥੇ ਆਵਾਜਾਈ ਬਹੁਤ ਹੈ ਜਿਸ ਨਾਲ ਆਵਾਜਾਈ ਦੇ ਨਾਲ ਇੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਅਤੇ ਇਸ ਨਾਲ ਗਰਮੀ ਵੀ ਵੱਧਦੀ ਜਾ ਰਹੀ ਹੈ ਇਸ ਕਰਕੇ ਸਾਡੇ ਇਲਾਕੇ ਦੇ ਲੋਕ ਠੰਡੇ ਬਰਫ਼ੀਲੀ ਅਤੇ ਹਵਾਦਾਰ ਇਲਾਕੇ ਵਿੱਚ ਜਾਣਾ ਪਸੰਦ ਕਰਦੇ ਹਨ ਜਿਵੇਂ ਕਿ ਹਿਮਾਚਲ ਪ੍ਰਦੇਸ਼ ਉਹ ਸਾਡੇ ਇਲਾਕੇ ਦੇ ਬਿਲਕੁਲ ਨੇੜੇ ਹੀ ਪੈਂਦਾ ਹੈ ਇਸ ਕਰਕੇ ਲੋਕੀਂ ਉੱਥੇ ਜ਼ਿਆਦਾ ਜਾਣਾ ਪਸੰਦ ਕਰਦੇ ਹਨ ਸਾਡੇ ਇਲਾਕੇ ਵਿੱਚ ਜਦੋਂ ਵੀ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਹਨ ਜਾਂ ਕੰਮਾਂ ਕਾਰਾਂ ਤੋਂ ਵਿਹਲ ਮਿਲਦੀ ਹੈ ਤਾਂ ਠੰਡੇ ਇਲਾਕੇ ਵਿੱਚ ਘੁੰਮਣ ਲਈ ਚਲੇ ਜਾਂਦੇ ਹਨ ਕਿਉਂਕਿ ਨਾ ਤਾਂ ਉੱਥੇ ਜ਼ਿਆਦਾ ਗੱਡੀਆਂ ਮੋਟਰਾਂ ਦੀਆਂ ਆਵਾਜਾਈ ਹੈ ਅਤੇ ਨਾ ਹੀ ਉੱਥੇ ਕੋਈ ਪ੍ਰਦੂਸ਼ਣ ਇਸ ਕਰਕੇ ਉੱਥੇ ਜ਼ਿਆਦਾ ਘੁੰਮਣਾ ਪਸੰਦ ਕਰਦੇ ਹਨ ਕਿਉਂਕਿ ਸਾਡੇ ਪੰਜਾਬ ਦੇ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਕਰਕੇ ਉੱਥੇ ਠੰਡੇ ਇਲਾਕੇ ਵਿੱਚ ਜਾਣਾ ਪਸੰਦ ਕਰਦੇ ਹਨ